ਖੇਡ ਖੇਡਣ ਦੌਰਾਨ ਜ਼ਖਮੀ ਜਾਂ ਹਾਦਸਿਆਂ ਦਾ ਸਾਹਮਣਾ ਕਰਨ ਵਾਲੇ ਸਪੋਸਟਸ ਲੋਕਾਂ ਦੇ ਲਈ ਰੋਪੜ ਖੇਤਰ ਦੇ ਵਿੱਚ ਪੁਨਰਵਾਸ ਦੀਆਂ ਬਹੁਤ ਸਹੂਲਤਾਂ ਹਨ ਜਿਵੇਂ ਕਿ ਜਿਹੜੇ ਸਰਕਾਰੀ ਹਸਪਤਾਲ ਨੇ ਜਿਹੜੇ ਸੁਰਜੀਤ ਡਾਕਟਰ ਹੈ ਜਿਹੜਾ ਇੱਥੇ ਹੱਡੀਆਂ ਦਾ ਬਹੁਤ ਵਧੀਆ ਡਾਕਟਰ ਹੈ ਸਰਕਾਰੀ ਹਸਪਤਾਲ ਦੇ ਵਿੱਚ ਫਿਜ਼ੀਓਥੈਰੇਪੀ ਵੀ ਮਿਲਦੀ ਹੈ ਅਤੇ ਜ਼ਿੰਦਲ ਹੌਸਪੀਟਲ ਹੈ ਜਿਹਦੇ ਵਿੱਚ ਮਸਲਜ਼ ਦਾ ਬਹੁਤ ਵਧੀਆ ਉੱਚ ਚੋਟੀ ਦੇ ਡਾਕਟਰ ਬਹਿੰਦੇ ਹਨ ਅਤੇ ਇਹ ਸਾਰੀ ਸਹੂਲਤਾਂ ਸਪੋਟਸ ਲੋਕਾਂ ਦੇ ਲਈ ਖ ਇਸ ਰੋਪੜ ਖੇਤਰ ਦੇ ਵਿੱਚ ਮਿਲਦੀਆਂ ਹਨ